ਤੇਈ ਦਸੰਬਰ ਉੱਨੀ ਸੌ ਅਠਾਸੀ ਦਸ ਅਕਤੂਬਰ ਉੱਨੀ ਸੌ ਚੁਰਾਸੀ ਦਸ ਜਨਵਰੀ ਅਠਾਰ੍ਹਾਂ ਸੌ ਬਿਆਸੀ ਛੇ ਫਰਵਰੀ ਸਤਾਰ੍ਹਾਂ ਸੌ ਇਕਾਨਵੇਂ ਇੱਕੀ ਜੂਨ ਸੋਲ਼੍ਹਾਂ ਸੌ ਨੜ੍ਹਿਨਵੇਂ